ਇੱਕ ਬੁਨਿਆਦੀ ਮਾਰਸ਼ਲ ਆਰਟ ਰੂਟੀਨ ਜੋ ਕਿ ਜ਼ਿਆਦਾਤਰ ਲੋਕਾਂ ਨੂੰ ਉਹਨਾਂ ਦੇ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਕਰਨ ਲਈ ਪਹੁੰਚ ਯੋਗ ਅਤੇ ਲਾਭਦਾਇਕ ਹੈ ਆਮ ਤੌਰ 'ਤੇ ਵਾਰਮਅਪ ਅਭਿਆਸਾਂ ਮੁੱਖ ਤਕਨੀਕਾਂ ਪੁਨਰ ਵਿਕਾਸ ਅਤੇ ਕੂਲ ਡਾਊਨ ਸਟਰੈਚ ਦਾ ਇੱਕ ਢਾਂਚਾਗਤ ਮਿਸ਼ਰਣ ਸ਼ਾਮਿਲ ਕਰਦਾ ਹੈ ਰੂਟੀਨ ਇੱਕ ਵਾਰਮਅਪ ਪੜਾਅ ਨਾਲ ਸ਼ੁਰੂ ਹੁੰਦੀ ਹੈ ਜੋ ਸਰੀਰ ਨੂੰ ਤਿਆਰ ਕਰਨ ਅਤੇ ਸੱਟ ਲੱਗਣ ਦੇ ਜੋਖਮ ਨੂੰ ਘਟਾਉਣ ਲਈ ਜ਼ਰੂਰੀ ਹੈ ਇਸ ਪੜਾਅ ਵਿੱਚ ਆਮ ਤੌਰ 'ਤੇ ਦਿਲ ਦੀ ਧੜਕਣ ਅਤੇ ਸਰਕੂਲੇਸ਼ਨ ਨੂੰ ਵਧਾਉਣ ਲਈ ਹਲਕੀ ਕਾਰਡੀਓ ਕਸਰਤਾਂ ਆਦਿ ਸ਼ਾਮਲ ਹੁੰਦੀਆਂ ਹਨ ਜਿਵੇਂ ਕਿ ਜੋਗਿੰਗ ਜਾਂ ਜੰਪਿੰਗ ਲਚਕਤਾ ਅਤੇ ਗਤੀਸ਼ੀਲਤਾ ਨੂੰ ਵਧਾਉਣ ਲਈ ਗਤੀਸ਼ੀਲ ਖਿੱਚਣ ਵਾਲੀਆਂ ਕਸਰਤਾਂ ਜਿਵੇਂ ਕਿ ਲੱਤਾਂ ਦੇ ਝੂਲੇ ਬਾਹਾਂ ਦੇ ਚੱਕਰ ਅਤੇ ਕਮਰ ਘੁੰਮਣਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਵਾਰਮਆਪ ਹੋਣ ਤੋਂ ਬਾਅਦ ਅਭਿਆਸੀ ਬੁਨਿਆਦਾਂ ਤਕਨੀਕ ਵੱਲ ਵੱਧਦੇ ਹਨ ਜੋ ਉਹਨਾਂ ਦੇ ਮਾਰਸਲ ਆਰਟ ਅਨੁਸ਼ਾਸਨ ਦੀ ਰੀੜ ਦੀ ਹੱਡੀ ਬਣਦੇ ਹਨ ਉਦਾਹਰਨ ਲਈ ਕਰਾਟੇ ਵਿੱਚ ਇਸ ਵਿੱਚ ਮੁੱਢਲੇ ਸਟਰਾਈਕ ਜਿਵੇਂ ਕਿ ਪੰਚਾਂ ਅਤੇ ਕਿੱਟਾਂ ਦਾ ਅਭਿਆਸ ਕਰਨਾ ਸ਼ਾਮਲ ਹੋ ਸਕਦਾ ਹੈ ਨਾਲ ਹੀ ਬੁਨਿਆਦੀ ਰੁੱਖ ਜਿਵੇਂ ਕਿ ਅੱਗ ਦਾ ਰੁੱਖ ਘੋੜੇ ਦਾ ਰੁੱਖ ਤਾਈਕਮਾਂਡੋ ਵਿੱਚ ਅਭਿਆਸੀ ਉੱਚੀਆਂ ਕਿੱਟਾਂ ਅਤੇ ਸਪਿਨਿੰਗ ਕਿੱਟਾਂ ਨੂੰ ਚਲਾਉਣ ਦੇ ਧਿਆਨ ਕੇਂਦਰਿਤ ਕਰਦੇ ਹਨ ਬ੍ਰਾਜ਼ੀਲ ਦੇ ਜਿਉਂਜਿਠਸੋ ਵਿੱਚ ਬੁਨਿਆਦੀ ਸਥਿਤੀ ਸਬੰਧੀ ਅਭਿਆਸਾਂ ਬਚਣ ਅਤੇ ਸਭਮਿਸ਼ਨ ਤਕਨੀਕਾਂ ਦੇ ਜ਼ੋਰ 'ਤੇ ਦਿੱਤਾ ਜਾ ਸਕਦਾ ਹੈ ਅਤੇ ਤਕਨੀਕ ਅਤੇ ਐਪਲੀਕੇਸ਼ਨ ਨੂੰ ਬਿਹਤਰ ਬਣਾਉਣ ਲਈ ਹੁਨਰ ਵਿਕਾਸ ਮਹੱਤਵਪੂਰਨ ਹੈ ਇਸ ਵਿੱਚ ਸ਼ੈਡੋ ਬਾਕਸਿੰਗ ਸ਼ਾਮਲ ਹੋ ਸਕਦੀ ਹੈ ਜਿੱਥੇ ਵਿਅਕਤੀ ਹਵਾ ਵਿੱਚ ਹਰਕਤਾਂ ਅਤੇ ਸੰਯੋਗਾਂ ਦਾ ਅਭਿਆਸ ਕਰਦੇ ਹਨ ਜਿਸ ਨਾਲ ਉਹ ਕਿਸੇ ਸਾਥੀ ਦੀ ਲੋੜ ਤੋਂ ਬਿਨਾਂ ਤਕਨੀਕ ਗਤੀ ਅਤੇ ਤਾਲਮੇਲ ਦੇ ਧਿਆਨ ਕੇਂਦਰਿਤ ਕਰ ਸਕਦੇ ਹਨ ਭਾਗੀਦਾਰਾਂ ਤੱਕ ਪਹੁੰਚ ਵਾਲੇ ਪ੍ਰੈਕਟੀਸ਼ਨਰਾਂ ਲਈ ਇੱਕ ਨਿਯੰਤਰਿਤ ਸੈਂਟਰ ਵਿੱਚ ਖ਼ਾਸ ਤਕਨੀਕਾਂ 'ਤੇ ਕੰਮ ਕਰਨ ਲਈ ਸਹਿਭਾਗੀ ਅਭਿਆਸਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ ਜਿਵੇਂ ਕਿ ਫੋਕਸ ਪੈਡ ਨਾਲ ਸੰਯੋਗਾਂ ਦਾ ਅਭਿਆਸ ਕਰਨਾ ਜਾਂ ਸਵੈ ਰੱਖਿਆ ਦ੍ਰਿਸ਼ਾਂ ਰਾਹੀਂ ਕੰਮ ਕਰਨਾ